ਹਾਂਜੀ ਮੈਂ ਬਹੁਤ ਸਾਰੇ ਅਜਿਹੇ ਇਲਾਕੇ ਹਨ ਜਿਨ੍ਹਾਂ ਵਿਚ ਮੈਂ ਘੁੰਮਣ ਫਿਰਨ ਜਾਂਦਾ ਹਾਂ ਜਿਹਨਾਂ ਦੀ ਭਾਸ਼ਾ ਅਲੱਗ ਹੈ ਅਤੇ ਮੇਨ ਤੌਰ 'ਤੇ ਅਗਰ ਮੈਂ ਦਿੱਲੀ ਜਾਂਦਾ ਹਾਂ ਤਾਂ ਉੱਥੇ ਮੇਨ ਤੌਰ 'ਤੇ ਜੋ ਭਾਸ਼ਾ ਹੈ ਹਿੰਦੀ ਹੈ ਅਤੇ ਅਜਿਹੇ ਜਦੋਂ ਮੈਂ ਜਦੋਂ ਉਹਨਾਂ ਲੋਕਾਂ ਕੋਲ ਮੈਂ ਜਾਂਦਾ ਹਾਂ ਤਾਂ ਮੈਨੂੰ ਮੈਂ ਹਿੰਦੀ ਵਿੱਚ ਗੱਲ ਕਰਦਾ ਹਾਂ ਅਤੇ ਇਸ ਤੋਂ ਇਲਾਵਾ ਜੋ ਹਿਮਾਚਲ ਹੈ ਹਿਮਾਚਲ ਦੀ ਭਾਸ਼ਾ ਥੋੜ੍ਹੀ ਹਿਮਾਚਲੀ ਹੈ ਜੋ ਕਿ ਪੰਜਾਬੀ ਟੱਚ ਨਾਲ਼ ਦੀ ਹੈ ਅਤੇ ਉਹਨਾਂ ਨਾਲ਼ ਵੀ ਮੈਂ ਉਹਨਾਂ ਦੀ ਭਾਸ਼ਾ ਵਿੱਚ ਹੀ ਗੱਲ ਸਕ ਗੱਲ ਕਰ ਗੱਲ ਕਰਦਾ ਹਾਂ ਅਤੇ ਇਸ ਤੋਂ ਇਲਾਵਾ ਜਿਹੜੇ ਹੋਰ ਪ ਭਾਰਤ ਦੇ ਹੋਰ ਵੀ ਜਿਹੜੇ ਹਿੱਸੇ ਹਨ ਉਹਨਾਂ ਵਿੱਚ ਮੇਨ ਤੌਰ 'ਤੇ ਹਿੰਦੀ ਬੋਲੀ ਜਾਂਦੀ ਹੈ ਅਤੇ ਮੈਂ ਉਹਨਾਂ ਲੋਕਾਂ ਨਾਲ਼ ਹਿੰਦੀ ਭਾਸ਼ਾ ਵਿੱਚ ਬੜੇ ਵਧੀਆ ਤਰੀਕੇ ਨਾਲ਼ ਗੱਲ ਕਰਦਾ ਹਾਂ ਜਦੋਂ ਪੰਜਾਬ ਵਿੱਚ ਅਸੀਂ ਘੁੰਮਦੇ ਹਾਂ ਤਾਂ ਮੇਨ ਤੌਰ 'ਤੇ ਪੰਜਾਬੀ ਭਾਸ਼ਾ ਦੇ ਲੋਕ ਮਿਲਦੇ ਹਨ ਅਤੇ ਇਹਨਾਂ ਵਿੱਚ ਪੰਜਾਬੀ ਭਾਸ਼ਾ ਵਿੱਚ ਵੀ ਚੰਗੀ ਤਰ੍ਹਾਂ ਮੈਂ ਬੋਲ ਲੈਨਾਂ ਮੈਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਜਾਂ ਪਰੇਸ਼ਾਨੀ ਨਹੀਂ ਹੁੰਦੀ